ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਂ ਨਾਈਂਨਥ ਏ ਦੇ ਵਿੱਚੋਂ ਬੋਲ ਰਿਹਾ ਜੀ ਬਿਰਜੇਸ਼ ਕੁਮਾਰ ਜਿਹੜੇ ਮੈਮ ਅਥਲੈਟਿਕਸ ਦੇ ਹੁਣ ਟੂਰਨਾਮੈਂਟ ਹੋਣੇ ਨੇ ਜੀ ਮੈਂ ਉਹਦੇ ਵਿੱਚ ਪਾਰਟੀਸਪੇਟ ਕਰਨਾ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਕੀ ਕੀ ਅਥਲੈਟਿਕਸ ਦੇ ਵਿੱਚ ਕਿਹੜੇ ਈਵੈਂਟ ਨੇ ਅਤੇ ਕੀ ਕੀ ਵੀ ਰਿਕੁਆਇਰਮੈਂਟਸ ਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਮੈਂ ਮਤਲਬ ਤੁਹਾਨੂੰ ਗਰਾਊਂਡ ਦੇ ਵਿੱਚ ਪਹੁੰਚ ਕੇ ਫੋਨ ਕਰ ਸਕਦਾ

ਓਕੇ ਥੈਂਕ ਯੂ ਮੈਮ